ਹੈਲੋ ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਦਾ ਲਾਈਫਸਟਾਈਲ ਸਹੀ ਕਰਨਾ ਪੈਣਾ ਜੇ ਤੁਹਾਨੂੰ ਆਪਦਾ ਗੱਟ ਹੈਲਥ ਆਪਦਾ ਪੇਟ ਸਹੀ ਰੱਖਣਾ ਤਾਂ ਤੁਹਾਨੂੰ ਉਹਦੇ ਲਈ ਰੋਜ਼ ਯੋਗਾ ਕਰਨਾ ਪੈਣਾ ਯੋਗਾ ਕਰੋਂਗੇ ਤਾਂ ਤੁਹਾਡੇ ਬੋਡੀ ਮੂਵਮੈਂਟਸ ਹੋਣਗੇ ਜਿਹੜਾ ਤੁਹਾਡਾ ਖਾਧਾ ਪੀਤਾ ਹੋਵੇਗਾ ਉਹ ਸਾਰਾ ਹਜਮ ਹੋਵੇਗਾ ਅਤੇ ਉਹਦੇ ਕਰਕੇ ਤੁਹਾਡਾ ਪੇਟ ਸਾਫ਼ ਹੋਵੇਗਾ ਦੂਜਾ ਗੱਲ ਇਹ ਵੀ ਤੁਹਾਨੂੰ ਟਾਈਮ 'ਤੇ ਖਾਣਾ ਖਾਣਾ ਹਮੇਸ਼ਾ ਜੇ ਟਾਈਮ 'ਤੇ ਖਾਉਂਗੇ ਫੇਰ ਹੀ ਟਾਈਮ 'ਤੇ ਚੀਜ਼ਾਂ ਪਚਣੀਆਂ ਠੀਕ ਹੈ ਜੀ ਅਤੇ ਤੁਹਾਨੂੰ ਦੂਜਾ ਹੈਗਾ ਕਿ ਫਾਈਬਰ ਅਤੇ ਪ੍ਰੋਟੀਨ ਇਨਟੇਕ ਵਧਾਉਣਾ ਪੈਣਾ ਅਤੇ ਜਿਹੜੇ ਕਾਰਬਸ ਹੁੰਦੇ ਹੈ ਉਹ ਘੱਟ ਕਰਨੇ ਹੈ ਅਤੇ ਸੁਬਾਹ ਤੁਸੀਂ ਮੋਰਨਿੰਗ ਆਪਦੀ ਫਰੂਟਸ ਅਤੇ ਫਰੂਟਸ ਨਾਲ ਸ਼ੁਰੂ ਕਰ ਸਕਦੇ ਓਂ ਸੁਬਾਹ ਤੁਸੀਂ ਜਿਵੇਂ ਕਿ ਆਪਣੇ ਕਾਜੂ ਬਦਾਮ ਇਹ ਸਾਰੀਆਂ ਚੀਜ਼ਾਂ ਖਾ ਸਕਦੇ ਓਂ ਅਤੇ ਤੁਸੀਂ ਦੁਪਹਿਰੇ ਦੋ ਰੋਟੀਆਂ ਨਹੀਂ ਚਾਹ ਨਹੀਂ ਪੀ ਸਕਦੀ ਚਾਹ ਜ਼ਹਿਰ ਆ ਤੈਨੂੰ ਹਾਂਜੀ ਚਾਹ ਅੰਦਰ ਆਪਣੇ ਐਸਿਡ ਬਣਾ ਦਿੰਦੀ ਹੈ ਜਿਹਦੇ ਕਰਕੇ ਹੋਰ ਪ੍ਰੋਬਲਮ ਹੁੰਦੀ ਆ ਜਿਨ੍ਹਾਂ ਦਾ ਪੇਟ ਖਰਾਬ ਹੁੰਦਾ ਹੈ ਚਾਹ ਨਹੀਂ ਪੀਣੀ ਤੁਸੀਂ ਅਤੇ ਦੁਪਹਿਰੇ ਫੇਰ ਤੁਸੀਂ ਦੋ ਰੋਟੀਆਂ ਸਬਜ਼ੀ ਵੱਧ ਤੋਂ ਵੱਧ ਅਤੇ ਇੱਕ ਗਲਾਸ ਲੱਸੀ ਦਾ ਅਤੇ ਨਾਲ ਸਲਾਦ ਇਹ ਜ਼ਰੂਰ ਖਾਣਾ ਹੈ ਇਹ ਖਾ ਕੇ ਫੇਰ ਤੁਸੀਂ ਅੱਧਾ ਘੰਟਾ ਗੇੜਾ ਕੱਢਣਾ ਹੈ ਅੱਧਾ ਘੰਟਾ ਗੇੜਾ ਕੱਢ ਕੇ ਅਤੇ ਸ਼ਾਮੀ ਜੇ ਤੁਹਾਨੂੰ ਭੁੱਖ ਲੱਗਦੀ ਹੈ ਅਤੇ ਤੁਸੀਂ ਓਦੋਂ ਦੁੱਧ ਪੀ ਸਕਦੇ ਓਂ ਵਿੱਚ ਹਲਦੀ ਪਾ ਕੇ ਠੀਕ ਹੈ ਅਤੇ ਰਾਤ ਨੂੰ ਤੁਸੀਂ ਹੈਵੀ ਨਹੀਂ ਖਾਣਾ ਰਾਤ ਨੂੰ ਤੁਸੀਂ ਸਿਰਫ਼ ਜਾਂ ਤਾਂ ਸੂਪ ਬਣਾ ਕੇ ਪੀ ਸਕਦੇ ਹੋ ਜਾਂ ਫੇਰ ਸਲਾਦ ਖਾ ਸਕਦੇ ਜਿਵੇਂ ਕਾਲੇ ਛੋਲਿਆਂ ਦਾ ਸਲਾਦ ਬਣਾ ਕੇ ਖਾ ਸਕਦੇ ਓਂ ਉਹ ਵਧੀਆ ਚੀਜ਼ ਹੈ ਅਤੇ ਮੋਰਨਿੰਗ 'ਚ ਤੁਸੀਂ ਬ੍ਰੇਕਫਾਸਟ ਦੇ ਵਿੱਚ ਜਿਵੇਂ ਪੋਹਾ ਉਪਮਾ ਹੋ ਗਿਆ ਆਪਣੇ ਬੇਸਣ ਦਾ ਚਿੱਲਾ ਹੋ ਗਿਆ ਇਹ ਸਾਰੀਆਂ ਚੀਜ਼ਾਂ ਜ਼ਿਆਦਾ ਤੋਂ ਜ਼ਿਆਦਾ ਸਬਜ਼ੀਆਂ ਪਾ ਕੇ ਬਣਾ ਸਕਦੇ ਓਂ ਅਤੇ ਤੀਜੀ ਚੀਜ਼ ਇਹ ਵੀ ਜੇ ਤੁਸੀਂ ਵੱਧ ਤੋਂ ਵੱਧ ਪਾਣੀ ਪੀਓਂਗੇ ਅਤੇ ਆਪੇ ਤੁਹਾਡਾ ਅੰਦਰ ਸਾਰਾ ਸਿਸਟਮ ਸੈੱਟ ਹੋਵੇਗਾ ਵੀ ਤੁਸੀਂ ਦਿਨ ਦਾ ਵੱਧ ਤੋਂ ਵੱਧ ਢਾਈ ਜਾਂ ਫੇਰ ਤਿੰਨ ਲੀਟਰ ਪਾਣੀ ਪੀਣਾ ਹੀ ਪੀਣਾ ਅਤੇ ਬਾਕੀ ਜੇ ਤੁਹਾਡੇ ਜਲਨ ਹੁੰਦੀ ਹੈ ਅਤੇ ਤੁਸੀਂ ਦਹੀਂ ਖਾ ਸਕਦੇ ਓਂ ਉਹਦੇ ਨਾਲ ਤੁਹਾਡਾ ਸੈੱਟ ਹੋਵੇਗਾ ਜਲਨ ਅਤੇ ਹੁਣ ਅੱਜ ਕੱਲ੍ਹ ਜਿਵੇਂ ਹੁਣ ਸਰਦੀਆਂ ਸ਼ੁਰੂ ਹੋਣ ਲੱਗੀਆਂ ਤਾਂ ਤੁਹਾਨੂੰ ਗਾਜਰ ਅਨਾਰ ਬੀਟਰੂਟ ਅਤੇ ਪਾਈਨਐਪਲ ਅਨਾਨਾਸ ਦਾ ਜੂਸ ਪੀਣਾ ਸਭ ਤੋਂ ਵੱਧ ਕਿਉਂਕਿ ਇਹ ਸਾਰੀਆਂ ਚੀਜ਼ਾਂ ਆਪਣੇ ਅੰਤੜੀਆਂ ਨੂੰ ਸਾਫ਼ ਕਰਦੀਆਂ ਹੈ ਠੀਕ ਹੈ ਅਤੇ ਬਾਹਰਲਾ ਖਾਣਾ ਬਿਲਕੁਲ ਨਹੀਂ ਖਾਣਾ ਅਤੇ ਜਿਹੜੇ ਬਰੈਡ ਹੁੰਦੇ ਹੈ ਬਰੈਡ ਵੀ ਤੁਸੀਂ ਜਮ੍ਹਾਂ ਘੱਟ ਕਰ ਦਿਓ ਠੀਕ ਹੈ ਹਾਂਜੀ ਬਾਕੀ ਮੈਂ ਤੁਹਾਨੂੰ ਚਾਈ ਡਾਈਟ ਚਾਟ ਬਣਾ ਕੇ ਦੇ ਦਿੰਦੀ ਹਾਂ ਅਤੇ ਤੁਸੀਂ ਉਹ ਫੋਲੋ ਕਰ ਲਿਓ ਅਤੇ ਜੇ ਬਾਕੀ ਮੈਂ ਸਪਲੀਮੈਂਟਸ ਲਿਖ ਕੇ ਦਿੱਤੇ ਆ ਵਾਈਟਾਮਿਨ ਸੀ ਵਗੈਰਾ ਅਤੇ ਉਹ ਵੀ ਤੁਸੀਂ ਲੈ ਲੈਣੇ ਟਾਈਮ ਨਾਲ ਬਸ ਥਾਉਜੈਂਟ ਰੁਪੀਸ ਮੈਡਮ ਥਾਉਜੈਂਟ ਰੁਪੀਸ